ਮੇਰਾ ਸਭ ਤੋਂ ਫੇਵਰੇਟ ਇਡਲੀ ਡੋਸਾ ਹੈ ਜੋ ਕਿ ਮੈਂ ਆਪਣੇ ਘਰ ਹੀ ਬਣਾਇਆ ਅਤੇ ਆਪਣੀ ਵਾਈਫ ਆਪਣੀ ਮੌਮ ਨੂੰ ਅਤੇ ਡੈਡ ਨੂੰ ਅਤੇ ਆਪਣੇ ਬ੍ਰਦਰ ਨੂੰ ਖਾਣ ਵਾਸਤੇ ਦਿੱਤਾ ਅਤੇ ਉਹਨਾਂ ਨੇ ਮੇਰੇ ਇਡਲੀ ਡੋਸੇ ਦਾ ਬਹੁਤ ਹੀ ਮੈਨੂੰ ਰਿਸਪੋਂਸ ਦਿੱਤਾ ਬਹੁਤ ਹੀ ਵਧੀਆ ਕਿਹਾ ਕਿਉਂਕਿ ਮੈਂ ਆਪਣੇ ਦੋਸਤ ਨਾਲ ਕਿਤੇ ਗਿਆ ਸੀ ਉਹ ਉਸਦੇ ਕੋਲੋਂ ਹੀ ਇਡਲੀ ਡੋਸਾ ਬਣਾਉਣਾ ਸਿੱਖਿਆ ਸੀ ਅਤੇ ਮੇਰੇ ਹੱਥ ਦੇ ਬਣਾਏ ਆਲੂ ਦੇ ਪਰੌਂਠੇ ਆਲੂ ਦੇ ਪਰੌਂਠੇ ਬਹੁਤ ਹੀ ਪਸੰਦ ਕਰਦੇ ਹਨ ਸਾਰੇ ਖ਼ਾਸ ਕਰਕੇ ਮੇਰੇ ਦੋਸਤ ਬਹੁਤ ਹੀ ਪਸੰਦ ਕਰਦੇ ਹਨ ਮੈਂ ਹਾਲੇ ਤੱਕ ਕਿਸੇ ਨੂੰ ਮਤਲਬ ਕਿਸੇ ਨੇ ਨਾ ਹੀ ਮੈਨੂੰ ਕਿਹਾ ਬਣਾਉਣਾ ਸਿਖਾਓ ਨਾ ਹੀ ਕਿਸੇ ਨੂੰ ਸਿਖਾਇਆ ਬਟ ਮੇਰੇ ਹੱਥ ਦੇ ਬਣਾਏ ਬਹੁਤ ਹੀ ਪਸੰਦ ਕਰਦੇ ਹਨ ਮੇਰੇ ਦੋਸਤ ਮੇਰੇ ਘਰ ਵਾਲੇ ਅਤੇ ਕੁਕਿੰਗ ਦੇ ਵਿੱਚ ਮੇਰਾ ਥੋੜ੍ਹਾ ਬਹੁਤਾ ਸ਼ੌਕ ਹੈ ਕੰਮ ਕੰਮ ਕਾਰ ਦੇ ਨਾਲ ਨਾਲ ਘਰ ਮੈਂ ਕੁਕਿੰਗ ਵੀ ਕਰਦਾ ਹਾਂ ਹਰ ਇੱਕ ਚੀਜ਼ ਬਣਾ ਲੈਂਦਾ ਹਾਂ